ਸਤਿ ਸ਼੍ਰੀ ਅਕਾਲ ਤੁਸੀਂ ਇਲੈਕਟ੍ਰੀਕਲ ਦੀ ਦੁਕਾਨ ਤੋਂ ਬੋਲਦੇ ਹੋ ਸਰ ਮੈਂ ਤੁਹਾਨੂੰ ਪਹਿਲਾਂ ਵੀ ਕੋਲ ਕੀਤੀ ਸੀ ਤੁਸੀਂ ਚੁੱਕੀ ਨਹੀਂ ਅੱਛਾ ਅੱਛਾ ਸਰ ਉਹ ਸ ਮੈਂ ਨਾ ਗੱਲ ਕਰਨੀ ਸੀ ਕਿ ਸਾਡੇ ਘਰ ਜਿਹੜੀ ਪਾਣੀ ਵਾਲੀ ਮੋਟਰ ਹੈ ਨਾ ਅਤੇ ਉਹ ਮੈਂ ਤਾਂ ਬਾਹਰ ਗਈ ਸੀ ਅਤੇ ਮੈਨੂੰ ਇੰਨਾ ਪਤਾ ਨਹੀਂ ਪਰ ਮੰਮਾਂ ਕਹਿਣ ਡਏ ਕਿ ਸਵੇਰ ਦੀ ਚੱਲੇ ਨਹੀਂ ਕਰਦੀ ਉਹ ਨਹੀਂ ਨਹੀਂ ਮੈਂ ਤਾਂ ਐਕਚੁਲੀ ਘਰ ਨਹੀਂ ਸੀ ਪਰ ਮੰਮਾਂ ਕਹਿਣ ਡਏ ਕਹਿੰਦੇ ਕਿ ਇਹਨੇ ਚਾਲੂ ਨਹੀਂ ਕੀਤੀ ਬਸ ਜਦੋਂ ਦੀ ਸਵੇਰ ਦੀ ਅਸੀਂ ਸ਼ੁਰੂ ਕਰਨ ਡੇ ਉਹ ਤਾਂ ਉਹ ਔਨ ਹੀ ਨਹੀਂ ਹੋਏ ਕਰਦੀ ਹਾਂਜੀ ਹਾਂਜੀ ਕੀਤੀ ਸੀ ਅਸੀਂ ਬੋਲਦੇ ਪਏ ਹਾਂ ਇੱਥੋਂ ਗੁਰਦਾਸਪੁਰ ਲਾਗੋਂ ਹਾਂਜੀ ਹਾਂਜੀ ਹਾਂਜੀ ਅਤੇ ਪਹਿਲਾਂ ਵੀ ਤੁਹਾਡੇ ਤੋਂ ਠੀਕ ਕਰਵਾਈ ਸੀ ਅਤੇ ਉਹ ਫੇਰ ਤੋਂ ਉਸੇ ਟਾਈਪ ਦਾ ਨੁਕਸ ਪੈ ਗਿਆ ਉਹਨੂੰ ਹਾਂਜੀ ਹਾਂਜੀ ਆਹ ਮੀਂਹ ਵੀ ਪਿਆ ਨਾ ਅਤੇ ਸ਼ਾਇਦ ਉਸੇ ਕਰਕੇ ਨਾ ਖਰਾਬ ਹੋ ਗਈ ਹੋਵੇ ਬਾ ਬਾਹਰ ਲੱਗੀ ਹੈ ਨਾ ਸਾਡੀ ਮੋਟਰ

ਨਹੀਂ ਨਹੀਂ ਕੋਈ ਨਹੀਂ ਤੁਸੀਂ ਭਾਵੇਂ ਕੱਲ ਆ ਜਿਓ ਅਜੇ ਤਾਂ ਹਨੇਰਾ ਹੋ ਗਿਆ ਹਾਂਜੀ ਹਾਂਜੀ ਅਤੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਆਰਾਮ ਨਾਲ ਆਇਓ ਪਰ ਸਵੇਰ ਤੱਕ ਆ ਜਿਓ ਕਿਉਂਕਿ ਫੇਰ ਦਿੱਕਤ ਹੋਣ ਡਈ ਊਂ ਕੰਮ ਕੁਮ 'ਚ ਹਾਂਜੀ ਹਾਂਜੀ ਤੁਹਾਨੂੰ ਪਤਾ ਤਾਂ ਹੋਣਾ ਹੀ ਹੈ ਘਰ ਦਾ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਦਾਂਗੀ ਤੁਹਾਨੂੰ ਸਤਿ ਸ਼੍ਰੀ ਅਕਾਲ